ਦਲਜੀਤ ਦੌਸਾਂਝ ਦੇ ਸਾਰੇ ਗੀਤ ਭੰਗੜੇ ਵਾਲੇ ਹੁੰਦੇ ਹਨ ਅਤੇ ਪੁਰਾਣੇ ਗਾਣਿਆਂ ਉੱਪਰ ਹੀ ਭੰਗੜਾ ਪੈਂਦਾ ਹੈ ਪੁਰਾਣੇ ਗਾਣੇ ਹੀ ਵਧ ਵਧੀਆ ਭੰਗੜੇ ਲਈ ਮੰਨੇ ਜਾਂਦੇ ਹਨ ਅਤੇ ਇਹਦੇ ਉੱਪਰ ਇਹ ਸਾਰਾ ਨੱਚ ਗਾਉਣ ਟੱਪ ਹੁੰਦਾ ਹੈ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਹੈ